ਸਤਿ ਸ਼੍ਰੀ ਅਕਾਲ ਜੀ ਤੁਸੀਂ ਲਖਵੀਰ ਬੁੱਕ ਹਾਊਸ ਤੋਂ ਬੋਲਦੇ ਹੋ ਮੈਂ ਤੁਹਾਡੇ ਤੋਂ ਪਿਛਲੇ ਦਿਨੀਂ ਇੱਕ ਔਨਲਾਈਨ ਬੁੱਕ ਔਰਡਰ ਕੀਤੀ ਸੀ ਮੈਨੂੰ ਜੋ ਤੁਸੀਂ ਟਰੈਕ ਕਰਨ ਲਈ ਆਈ ਡੀ ਦਿੱਤੀ ਸੀ ਉਸ ਤੋਂ ਪਤਾ ਲੱਗ ਰਿਹਾ ਹੈ ਕਿ ਮੇਰੀ ਬੁੱਕ ਡਿਲੀਵਰ ਹੋ ਚੁੱਕੀ ਹੈ ਪਰ ਤਿੰਨ ਦਿਨ ਹੋ ਗਏ ਨੇ ਮੈਨੂੰ ਮੇਰੀ ਬੁੱਕ ਨਹੀਂ ਮਿਲੀ ਇਹ ਮੈਨੂੰ ਬਹੁਤ ਜ਼ਰੂਰੀ ਚਾਹੀਦੀ ਸੀ ਮੈਂ ਤਾਂ ਇਸ ਦੇ ਪੈਸੇ ਵੀ ਤੁਹਾਨੂੰ ਪਹਿਲਾਂ ਦੇ ਚੁੱਕਿਆ ਹਾਂ ਜਾਂ ਤਾਂ ਤੁਸੀਂ ਮੈਨੂੰ ਮੇਰੀ ਬੁੱਕ ਦੁਬਾਰਾ ਜਲਦੀ ਤੋਂ ਜਲਦੀ ਭੇਜੋ ਜਾਂ ਮੇਰੇ ਪੈਸੇ ਵਾਪਸ ਕਰ ਦਿਓ